ਸਤਿ ਸ਼੍ਰੀ ਅਕਾਲ ਮੈਂ ਪੰਜਾਬ ਪਠਾਨਕੋਟ ਵਿੱਚ ਰਹਿਣ ਵਾਲਾ ਵਿਦਿਆਰਥੀ ਹਾਂ ਅਤੇ ਜਿਵੇਂ ਦੱਸਦਾ ਹਾਂ ਕਿ ਪੰਜਾਬ ਵਿੱਚ ਕਈ ਕਈ ਸੱਭਿਆਚਾਰ ਵਾਲੇ ਰਹਿਣ ਵਾਲੇ ਸਮੂਹ ਹਨ ਇਹ ਜਿਹੜੇ ਚਾਰ ਸਮੂਹ ਹਨ ਇਹ ਚਾਰੇ ਜਿਹੜੇ ਸਮੂਹ ਹੈ ਇਹ ਆਪਣੇ ਅਲੱਗ ਅਲੱਗ ਤਰ੍ਹਾਂ ਰਹਿੰਦੇ ਹਨ ਅਤੇ ਆਪਣਾ ਅਲੱਗ ਅਲੱਗ ਇੱਕ ਪਹਿਰਾਵਾ ਹੈ ਅਤੇ ਇਹ ਅਪ ਇਹਨਾਂ ਬਾਰੇ ਕੀ